ਮੈਂ ਗਣਿਤ ਦੇ ਮੋਡਲ ਹਮੇਸ਼ਾ ਬਣਾਉਂਦੀ ਰਹਿੰਦੀ ਹਾਂ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਜਿਹੜੇ ਮੈਂ ਮੋਡਲ ਬਣਾਉਂਦੀ ਹਾਂ ਉਸ ਨੂੰ ਮੇਰੇ ਮਾਪੇ ਮੇਰੇ ਦੋਸਤ ਜਾਂ ਵਿਦਿਆਰਥੀ ਬਹੁਤ ਪਸੰਦ ਕਰਦੇ ਨੇ ਮੈਨੂੰ ਵੱਖ ਵੱਖ ਤਰ੍ਹਾਂ ਦੀਆਂ ਫੀਡਬੈਕਸ ਦਿੰਦੇ ਨੇ ਕਿ ਜਿਹੜੇ ਤੁਸੀਂ ਮੋਡਲ ਬਣਾਉਂਦੇ ਹੋ ਉਹ ਸਾਡੇ ਬਹੁਤ ਕੰਮ ਆਉਂਦੇ ਹਨ